ਹੈਲੋ ਹਾਂ ਵੀ ਵਿਜਾਤ ਵਧੀਆ ਵਧੀਆ ਹੋਰ ਸੁਣਾ ਕਿੱਥੇ ਖਾਣ ਜਾਣਾ ਅੱਜ ਕੁਛ ਫਾਸਟ ਫੂਡ

ਕਿੱਥੇ ਜਾਣਾ ਕਿੱਥੇ ਜਾਣਾ ਹਰੀਵਾਲ ਫੂਡ ਜਾਣਾ ਅੱਛਾ ਹਰੀਵਾਲ ਫੂਡ ਕਿੱਥੇ ਆ ਕਿੱਥੇ ਕੀ ਕਹਿੰਦਾ

ਕੀ ਕਹਿੰਦਾ ਉਹ ਤੇ ਗੱਲ ਸਹੀ ਹ ਤੇਰੀ ਇਸੇ ਤੋਂ ਖਾਣਾ ਕੀ ਆ ਅੱਛਾ ਅੱਛਾ ਠੀਕ ਆ ਹੈਲੋ ਹਾਂ ਕੀ ਕਹਿੰਨਾ ਨਹੀਂ ਨਹੀਂ ਐਨੇ ਦਾ ਫਾਸਟਫੂਡ ਕਿੱਥੇ ਹੁੰਦਾ ਹਾਂ ਅੱਛਾ ਤੂੰ ਕੀ ਖਾਣਾ ਚਾਹੁੰਦਾ ਸੀ ਚੋਵੀ ਚੋਵਿਨ ਮੋਮੋਜ਼ ਕੀ ਬਰਗਰ ਬਰਗਰ ਚੋਮਿਨ ਟਿੱਕੀ ਉਹ ਤੇ ਵਿੱਚੇ ਹੁੰਦਾ ਬਰਗਰ ਦੇ ਵਿੱਚੇ ਹੁੰਦਾ ਆ ਹਾ ਹੈਗੇ ਪੈਸੇ ਅੱਛਾ ਚਲੋ ਹੋਰ ਮਸ਼ਹੂਰ ਹੋਰ ਕਿਹੜਾ ਇੱਕ ਮਸ਼ਹੂਰ ਜਲੇਬੀ ਵਾਲਾ ਉੱਥੇ ਹਨਾ ਹੋਰ ਗੁਲਾਬ ਜਾਮਨ ਤੈਨੂੰ ਮੈਂ ਖਿਲਾਊਗਾ ਆਜੀ ਗੁਲਾਬ ਜਾਮੁਨ ਇੱਧਰੋ ਉੱਧਰ ਹਾਂਜੀ ਚਾਚਾ ਇਧਰੋਂ ਆਜੋ ਕੋਈ ਨਾ ਚਲ ਠੀਕ ਆ ਖਾ ਕੇ ਆਵਾਂਗੇ ਆਪਾਂ ਹੋਰ ਹੋਰ ਹੋਰ ਇੱਕ ਡੋਮੀਨੋਜ ਆ ਡੋਮੀਨੋਸ ਵੀ ਜਾ ਕੇ ਦੇਖ ਆਵਾਂਗੇ ਆਪਣਾ ਚਾਹੇ ਜਿਆਦਾ ਉਥੇ ਜਾਇਆਵਾਂਗੇ ਆਪਣਾ ਚਾਏ ਵਾਲੇ ਕੋ ਪਤਾ ਵਾਲੇ ਕੋ ਹੋਰ ਹੋਰ

ਡੱਬਾ ਨੀ ਡੱਪਾ ਪੈ ਗਿਆ ਸੀ ਮੈਂਖਿਆ ਅੱਜ ਦਾ ਆਪਣਾ ਚਾਏ ਵਾਲਾ ਉੱਥੇ ਵੀ ਵਧੀਆ ਮਿਲਦੀ ਐ ਚੀਜ਼ਾਂ ਖਾਣ ਦੇ ਪੀਣ ਨੂੰਦੀ ਹਾਂ ਚਲ ਠੀਕ ਆ ਮੈਂ ਆਪਾਂ ਚਲਦੇ ਕੱਲ ਚਲਾਂਗੇ ਓਕੇ ਬਾਏ ਬਾਏ ਟੇਕ ਕੇ ਲਵ ਯੂ